ਹੈਲੋ ਪ੍ਰੀਤ ਕੀ ਹਾਲ ਚਾਲ ਹੈ ਮੈਂ ਤੇਰੇ ਨਾਲ ਚੈਟ ਉੱਤੇ ਇੱਕ ਫ਼ਿਲਮ ਦਾ ਜ਼ਿਕਰ ਕੀਤਾ ਸੀ ਫ਼ਿਲਮ ਨਾ ਅੱਜ ਤੋਂ ਤਕਰੀਬਨ ਹਫ਼ਤੇ ਬਾਅਦ 'ਚ ਯਾਨੀ ਕਿ ਸਤਾਰਾਂ ਮਾਰਚ ਨੂੰ ਲੱਗਣ ਜਾ ਰਹੀ ਹੈ ਫ਼ਿਲਮ ਵਿੱਚ ਬਹੁਤ ਐਕਸ਼ਨ ਸੀਨਜ਼ ਨੇ ਤੂੰ ਚੇਤਾ ਰੱਖੀਂ ਫਿਰ ਆਪਾਂ ਉਹ ਫ਼ਿਲਮ ਦੇਖਣ ਜਾਣਾ ਠੀਕ ਹੈ ਤੂੰ ਵੀ ਬਹੁਤ ਖੁਸ਼ ਹੋਵੇਂਗਾ ਉਹ ਫ਼ਿਲਮ ਨੂੰ ਦੇਖ ਕੇ